ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਭਾਅ ਜੀ ਜੀ ਭਾਅ ਜੀ ਅਸੀਂ ਨਾ ਆਪਣੇ ਘਰ ਵਿੱਚ ਲਾਈਟਿੰਗ ਦਾ ਕੰਮ ਕਰਵਾਉਣਾ ਸੀਗਾ ਸਾਰਾ ਇਲੈਕਟਰੋਨਿਕ ਸਬਸੀਟਿੰਗ ਵਗੈਰਾ ਸਭ ਹਾਂਜੀ ਹਾਂਜੀ ਹਾਂਜੀ ਅਤੇ ਤੁਸੀਂ ਆ ਜਾਓ ਇੱਕ ਵਾਰੀ ਕਰ ਦੇਖ ਜਾਓ ਸਭ ਹਾਂਜੀ ਹਾਂਜੀ ਠੀਕ ਹੈ ਲੱਗੇ ਹਾਂਜੀ ਹਾਂਜੀ ਭਾਅ ਜੀ ਤੁਸੀਂ ਖੁਦ ਹੀ ਖੁਦ ਹੀ ਆ ਨਾ ਤੁਸੀਂ ਤਾਂ ਕਿ ਥੋੜ੍ਹਾ ਤੁਹਾਨੂੰ ਜ਼ਿਆਦਾ ਪਤਾ ਹੁੰਦਾ ਵਰਕਰ ਨੂੰ ਕਿਉਂਕਿ ਸਾਨੂੰ ਇੱਕਦਮ ਵਧੀਆ ਕੰਮ ਵਧੀਆ ਕੁਆਲਿਟੀ ਦਾ ਚਾਹੀਦਾ ਸਿੰਗਲ ਹੀ ਹੈ ਸਿੰਗਲ ਹਾਂਜੀ ਥਰੀ ਰੂਮ ਸੈਟ ਹੈ ਟੂ ਹਾਂਜੀ ਸਭ ਪੂਰਾ ਫੁੱਲ ਫੁੱਲ ਪੂਰਾ ਕਰਨਾ ਸਾਰਾ ਅੰਦਰ ਤੋਂ ਲੈ ਕੇ ਬਾਹਰ ਤੱਕ ਟੋਇਲਟ ਵਗੈਰਾ ਦੀ ਸਭ ਸੀੜੀਆਂ ਵਗੈਰਾ ਸਾਰੀ ਕੰਪਲੀਟ ਕਰਨੀ ਹੈ ਹਾਂਜੀ ਸਾਰਾ ਮਤਲਬ ਹਾਲੀ ਤਿਆਰ ਹੋ ਰਹੀ ਹੈ ਪਲਸਤਰ ਵਗੈਰਾ ਨਹੀਂ ਹੋਈ ਕੋਠੀ ਉਸ ਤੋਂ ਪਹਿਲੇ ਆ ਕੇ ਤੁਸੀਂ ਫਿਟਿੰਗ ਵਗੈਰਾ ਕਰ ਜਾਓਗੇ ਉਸ ਤੋਂ ਬਾਅਦ ਫਿਰ ਆਪਾਂ ਲਾਈਟਿੰਗ ਵਗੈਰਾ ਦੇ ਡਿਜ਼ਾਇਨ ਦੇਖ ਲਾਂਗੇ ਫਿਰ ਉਸ ਤੋਂ ਉਹ ਕਰ ਲਾਂਗੇ ਕੇ ਆਈ ਹੈ ਨਾ ਹਾਂਜੀ ਡ ਹਾਂਜੀ ਡਰਾਇੰਗ ਰੂਮ ਡਰਾਇੰਗ ਰੂਮ ਵਿੱਚ ਥਰੀ ਡੀ ਵਗੈਰਾ ਲਗਾਉਣੀ ਹੈ ਬਾਹਰ ਜੋ ਗੇਟ ਦੇ ਉੱਪਰ ਵੀ ਸਭ ਥਰੀ ਡੀ ਵਗੈਰਾ ਲਗਾਉਣੀ ਹੈ ਹਾਂਜੀ ਲੈਂਪ ਵਗੈਰਾ ਲੁਕਿੰਗ ਵੀ ਅੱਛੀ ਹੋਣੀ ਚਾਹੀਦੀ ਅੱਛਾ ਜੀ ਹਾਂਜੀ ਤੁਹਾਡੇ ਕੋਲ ਸੋਲਰ ਲਾਈਟ ਵੀ ਹੈਗੀਆਂ ਜਿੱਦਾਂ ਸਟਰੀਟ ਵਗੈਰਾ ਵਿੱਚ ਲਗਾਉਣੀ ਹੈ ਤਾਂ ਅੱਛਾ ਸੋਲਰ ਲਾਈਟ ਦਾ ਸਹੀ ਚਲਦਾ ਅੱਛਾ ਜੀ ਅੱਛਾ ਅੱਛਾ ਜੀ ਅੱਛਾ ਜੀ ਔਰ ਐਨਦੀ ਫਿਟਿੰਗ ਵਗੈਰਾ ਦੀ ਕੋਈ ਹੈ ਗਰੰਟੀ ਕੁਛ ਵਾਇਰ ਵਗੈਰਾ ਸ਼ੋਰਟ ਕਰੇਗੀ ਤਾਂ ਤੁਸੀਂ ਕਰਕੇ ਜੋ

ਅੱਛਾ ਜੀ ਅੱਛਾ ਜੀ ਜਦੋਂ ਵੀ ਕੋਈ ਦਿੱਕਤ ਆਏ ਫਿਟਿੰਗ ਵਿੱਚ ਤੁਹਾਡੇ ਵਰਕਰ ਪਹੁੰਚਣਗੇ ਕਿਉਂਕਿ ਜੋ ਫਿਟਿੰਗ ਕਰੇਗਾ ਉਹਨਾਂ ਨੂੰ ਪਤਾ ਹੁੰਦਾ ਨਾ ਇੱਥੋਂ ਕੀ ਕੀਤਾ ਆਪਾਂ ਕਿਉਂਕਿ ਇਹ ਨਾ ਹੋਏ ਆ ਸਾਡੇ ਘਰ ਪ੍ਰੋਬਲਮ ਹੋਏ ਤੁਹਾਡਾ ਵਰਕਰ ਹੀ ਨਾ ਪਹੁੰਚੇ ਆਹ ਦਿੱਕਤ ਨਹੀਂ ਆਉਣੀ ਚਾਹੀਦੀ ਸਾਨੂੰ ਅੱਛਾ ਜੀ ਤੁਸੀਂ ਇੱਕ ਵਾਰੀ ਆ ਕੇ ਸਾਡਾ ਕੋਠੀ ਦਾ ਦੇਖ ਕੇ ਜਾਓ ਅਤੇ ਫਿਰ ਆਪਾਂ ਡਿਜਾਇਨਿੰਗ ਵਗੈਰਾ ਦੇਖ ਜਾਂਗੇ ਤੁਹਾਡੀ ਦੁਕਾਨ 'ਤੇ ਆ ਕੇ ਹਾਂਜੀ ਜੀ ਠੀਕ ਹੈ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਓਕੇ